ਮੇਰਾ ਇਹ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਮਸ਼ੀਨੀ ਯੁੱਗ ਹੋ ਚੁੱਕਿਆ ਕਿ ਜਿਵੇਂ ਕਿ ਆਪਾਂ ਕਣਕ ਲਗਾਉਂਦੇ ਹਾਂ ਤਾਂ ਉਹ ਵੀ ਮਸ਼ੀਨ ਨਾਲ ਲਗਾਉਂਦੇ ਹਾਂ ਵੱਢਦੇ ਹਾਂ ਉਹ ਵੀ ਮਸ਼ੀਨ ਨਾਲ ਵੱਢਦੇ ਹਾਂ ਝੋਨਾ ਹੋ ਗਿਆ ਉਹ ਵੀ ਲਗਾਉਂਦੇ ਹਾਂ ਤਾਂ ਆਪਾਂ ਹੁਣ ਮਸ਼ੀਨ ਨਾਲ ਲਗਾਉਣ ਲੱਗ ਗਏ ਵੱਢਦੇ ਉਹ ਵੀ ਮਸ਼ੀਨ ਨਾਲ ਲਗਾਉਣ ਲੱਗ ਗਏ ਅੱਜ ਦੇ ਸਮੇਂ 'ਚ ਤਾਂ ਮੰਨਣਾ ਇਹੀ ਆ ਕਿ ਵੀ ਹੁਣ ਮਸ਼ੀਨੀ ਯੁੱਗ ਹੋ ਚੁੱਕਿਆ ਵੀ ਲੇਬਰ ਦਾ ਕੰਮ ਜਮਾ ਹੀ ਖਤਮ ਹੋ ਰਿਹਾ ਅਤੇ ਲੇਬਰ ਦਾ ਕੰਮ ਖਤਮ ਖਤਮ ਖਤਮ ਹੁੰਦਾ ਹੁੰਦਾ ਹੀ ਖਤਮ ਹੋ ਗਿਆ